ਮੈਂ ਔਨਲਾਈਨ ਕਮੀਜ਼ ਮੰਗਵਾਈ ਸੀ ਕਮੀਜ਼ ਮੈਨੂੰ ਬਹੁਤ ਮਹਿੰਗੀ ਪਈ ਇਸ ਕਰਕੇ ਮੈਂ ਕਮੀਜ਼ ਨੂੰ ਜਦੋਂ ਮੈਂ ਬਾਜ਼ਾਰ ਵਿੱਚ ਗਈ ਤਾਂ ਮੈਨੂੰ ਕਮ ਉਹੀ ਕਮੀਜ਼ ਇੱਥੋਂ ਮੈਨੂੰ ਸੱਤ ਸੌ ਦੀ ਮਿਲੀ ਸੀ ਅਤੇ ਜਦੋਂ ਮੈਂ ਬਾਜ਼ਾਰ ਵਿੱਚ ਗਈ ਤਾਂ ਉਹ ਛੇ ਸੌ ਦੀ ਸੀ ਉਹੀ ਕੱਪੜਾ ਸੀ ਉਹੀ ਰੰਗ ਸੀ ਉਹੀ ਸਾਰਾ ਕੁਝ ਸੀਗਾ ਇਸ ਕਰਕੇ ਮੈਂ ਕਮੀਜ਼ ਉਹ ਰੱਦ ਕਰਨੀ ਚਾਹੁੰਦੀ ਹਾਂ ਜਦੋਂ ਮੈਂ ਰ ਰੱਦ ਕਰਨੀ ਚਾਹੁੰਦੀ ਹਾਂ ਮੈਨੂੰ ਉਹ ਕਮੀਜ਼ ਮਹਿੰਗੀ ਕਰਕੇ ਮੈਂ ਕਮੀਜ਼ ਉਹ ਨਹੀਂ ਲੈ ਸਕਦੀ ਮੈਂ ਜਦੋਂ ਕਮੀ ਉਸ ਓ ਔਨਲੈਨ ਵਾਲੇ ਭਾਈ ਕੋਲ ਜਾਊਂਗੀ ਤਾਂ ਕਮੀਜ਼ ਮੈਂ ਰੱਦ ਕਰੂੰਗੀ ਉਹ ਬਟਨ ਦਬਾਊਂਗੀ ਜੇ ਉਹਨਾਂ ਨੇ ਮੈਨੂੰ ਕਿਹਾ ਵੀ ਕਮੀਜ਼ ਨਹੀਂ ਰੱਦ ਕਰਨੀ ਮੈਂ ਰੱਦ ਜ਼ਰੂਰ ਕਰੂੰਗੀ ਇਸ ਕਰਕੇ ਮੈਨੂੰ ਕਮੀਜ਼ ਜ਼ਰੂਰ ਬਦਲ ਬਦਲ ਕੇ ਦਿਓ ਮੈਂ ਕਮੀਜ਼ ਨਹੀਂ ਲੈਣੀ ਮੈਨੂੰ ਕਮੀਜ਼ ਸਸਤੇ ਰੇਟ ਵਿੱਚ ਮਿਲਦੀ ਹੈ ਇਹ ਕਮੀਜ਼ ਮਹਿੰਗੀ ਪੈਂਦੀ ਹੈ ਮੈਨੂੰ ਇਸ ਕਰਕੇ ਵੀ ਮੈਂ ਕਮੀਜ਼ ਨਹੀਂ ਲੈਣੀ ਚਾਹੁੰਦੀ ਓਨਲੈਨ ਇਸ ਕਰਕੇ ਕਮੀਜ਼ ਉਹ ਬਹੁਤ ਮਹਿੰਗੀ ਆਈ ਮੈਂ ਕਮੀਜ਼ ਸਸਤੀ ਖਰੀਦ ਸ ਖਰੀਦ